ਵੈਸੇ ਤਾਂ ਮੈਨੇ ਵਰਕਸ਼ੋਪ ਜਾਂ ਕੂਕਿੰਗ ਕਲਾਸਾਂ ਵਿੱਚ ਕਦੇ ਵੀ ਭਾਗ ਨਹੀਂ ਲਿਆ ਤਾਂ ਏ ਮੈਨੂੰ ਪਿਛਲੇ ਦਿਨਾਂ ਵਿੱਚ ਛੁੱਟੀ ਸੀ ਤਾਂ ਮੈਨੇ ਦੇਖਿਆ ਕਿ ਯੂਟਿਊਬ 'ਤੇ ਰੈਸੀਪੀ ਬਾਰੇ ਦੇਖਿਆ ਤਾਂ ਉਸ ਵਿੱਚ ਮੈਨੂੰ ਡੋਸੇ ਦੀ ਰੈਸੀਪੀ ਜ਼ਿਆਦਾ ਅੱਛੀ ਲੱਗੀ ਤਾਂ ਕਰਕੇ ਮੈਨੇ ਸੋਚਿਆ ਕਿ ਮੈਂ ਡੋਸਾ ਬਣਾਉਂਗੀ ਫਿਰ ਉਨ੍ਹਾਂ ਨੇ ਮੈਨੂੰ ਵੀਡੀਓ ਵਿੱਚ ਦਿਖਾਇਆ ਜਿਵੇਂ ਕਿ ਓ ਦਾਲ ਅਤੇ ਚੋਲਾਂ ਨੂੰ ਓਵਰਨਾਈਟ ਲਈ ਰੱਖ ਤਾ ਉਨ੍ਹਾਂ ਨੇ ਫਿਰ ਅਗਲੇ ਦਿਨ ਉਹਨਾਂ ਨੇ ਚੋਲਾਂ ਦੇ ਵਿੱਚ ਜਿਹੜਾ ਪਾਣੀ ਸੀ ਉਹ ਨਿਕਾਲ ਕੇ ਫਿਰ ਉਹਨੂੰ ਗਰੈਂਡ ਕਰਤਾ ਗਰੈਂਡ ਕਰਨ ਤੋਂ ਬਾਅਦ ਉਨ੍ਹਾ ਨੇ ਇੱਕ ਪੇਸਟ ਬਣਾ ਲਿਆ ਪੇਸਟ ਤੋਂ ਬਾਅਦ ਉਨ੍ਹਾਂ ਨੇ ਇੱਕ ਤਵਾ ਲਿਆ ਡੋਸਾ ਤਵਾ ਉਸ 'ਤੇ ਘਿਓ ਪਾ ਕੇ ਥੋੜ੍ਹਾ ਜਿਹਾ ਫਿਰ ਉਹਨੂੰ ਸਪਰੈਡ ਕੀਤਾ ਪੇਸਟ ਨੂੰ ਪੇਸਟ ਨੂੰ ਸਪਰੈਡ ਕਰਕੇ ਉਨ੍ਹਾਂ ਨੇ ਇੱਕ ਪਾਸੇ ਤੋਂ ਹੀ ਡੋਸੇ ਨੂੰ ਰਾੜ ਲਿਆ ਅਤੇ ਦੂਸਰੇ ਪਾਸੇ ਉਨ੍ਹਾਂ ਨੇ ਪਟੈਟੋ ਦੀ ਉਹ ਬਣਾਇਆ ਹੋਇਆ ਸੀ ਪਟੈਟੋ ਦੇ ਬਣਾਇਆ ਹੋਇਆ ਸੀ ਉਹਦੇ ਵਿੱਚ ਫਿਰ ਉਨ੍ਹਾਂ ਨੇ ਪਟੈਟੋ ਵਿੱਚ ਫਿੱਲ ਕਰਤਾ ਫਿੱਲ ਕਰਕੇ ਫਿਰ ਉਨ੍ਹਾਂ ਨੇ ਬਾਅਦ 'ਚੋਂ ਡੋਸੇ ਨੂੰ ਉਹ ਲਪੇਟ ਤਾ ਫਿਰ ਡੋਸਾ ਬਣ ਕੇ ਤਿਆਰ ਹੋ ਗਿਆ ਅਤੇ ਫਿਰ ਉਸ ਤੋਂ ਬਾਅਦ ਜੇਕਰ ਮੈਨੂੰ ਇਹ ਮੌਕਾ ਮਿਲੇਗਾ ਤਾਂ ਮੈਂ ਇਹ ਜ਼ਰੂਰ ਸਿੱਖਣਾ ਚਾਹੁੰਗੀ